ਇੱਕ ਜਨਵਰੀ ਦੋ ਹਜ਼ਾਰ ਦਸ ਤੇਰ੍ਹਾਂ ਅਗਸਤ ਦੋ ਹਜ਼ਾਰ ਪੰਜ ਇੱਕ ਅਪ੍ਰੈਲ ਉੱਨੀ ਸੌ ਪੈਂਹਠ ਤੇਈ ਦਿਸੰਬਰ ਉੱਨੀ ਸੌ ਸੋਲ੍ਹਾਂ ਤੀਹ ਮਈ ਉੱਨੀ ਸੌ ਅੱਠ